ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਤੁਹਾਡੇ ਤੋਂ ਰੇਡਮੀ ਦਾ ਫੋਨ ਲਿਆ ਸੀ ਅਤੇ ਉਹ ਬਹੁਤ ਵਧੀਆ ਹੈ ਅਤੇ ਜਿਹੜੀ ਇਹਦੀ ਬੈਟ ਮੈਮਰੀਸ ਵਗੈਰਾ ਬਹੁਤ ਵਧੀਆ ਹੈ ਅਤੇ ਕੈਮਰਾ ਵੀ ਬਹੁਤ ਅੱਛਾ ਹੈ ਸੈਲਫੀ ਵੀ ਬਹੁਤ ਵਧੀਆ ਲੈਂਦਾ ਹੈ ਅਤੇ ਮਿਊਜ਼ਿਕ ਵਗੈਰਾ ਵੋਆਇਸ ਵੀ ਬਹੁਤ ਅੱਛੀ ਹੈ ਇਹਦਾ ਜਿਹੜੀ ਰੈਮ ਹੈ ਉਹ ਵੀ ਬਹੁਤ ਵਧੀਆ ਹੈ ਅਤੇ ਜਿੰਨਾ ਬੈਟਰੀ ਬੈਕਅੱਪ ਵੀ ਇਹਦਾ ਬਹੁਤ ਵਧੀਆ ਹੈ ਅਤੇ ਸਭ ਕੁਛ ਬਹੁਤ ਵਧੀਆ ਹੈ ਅਤੇ ਇਹਦਾ ਵਧੀਆ ਵਧੀਆ ਇਹਦਾ ਚਾਰਜਰ ਵੀ ਜਿਹੜਾ ਹੈ ਬਹੁਤ ਵਧੀਆ ਅਤੇ ਇਹਦੇ ਨਾਲ ਮੈਨੂੰ ਹੈਡਫੋਨ ਮਿਲੇ ਸੀ ਉਹ ਉਹਦੇ ਵਿੱਚ ਵੀ ਵਧੀਆ ਆਵਾਜ਼ ਸੁਣਦੀ